ਹਾਂਜੀ ਅਸੀਂ ਗੂਗਲ ਮੈਪਸ ਦੀ ਵਰਤੋਂ ਬਹੁਤ ਵਾਰ ਕੀਤੀ ਹੈ ਤਕਰੀਬਨ ਅਸੀਂ ਜਾਂਦੇ ਰਹਿੰਦੇ ਹੈਗੇ ਆਪਣੇ ਵਹੀਕਲ ਦੇ ਉੱਤੇ ਗੂਗਲ ਮੈਪਸ ਦੇ ਉੱਤੇ ਕੀ ਹੈ ਅਸੀਂ ਕਿੱਥੋਂ ਚੱਲਣਾ ਕਿਹੜੀ ਜਗ੍ਹਾ 'ਤੇ ਪਹੁੰਚਣਾ ਅਸੀਂ ਉਹ ਅਸੀਂ ਗੂਗਲ ਮੈਪ 'ਤੇ ਭਰ ਦਿੰਦੇ ਹਾਂ ਤਾਂ ਸਾਨੂੰ ਉਹ ਡਰੈਕਸ਼ਨ ਦੇ ਕੇ ਜਿਹੜਾ ਵੀ ਰਸਤਾ ਹੈ ਕੋਈ ਮੋੜ ਆ ਕੋਈ ਪਿੰਡ ਆ ਕੋਈ ਕਸਬਾ ਕੋਈ ਸ਼ਹਿਰ ਆ ਜਿੱਥੋਂ ਦੀ ਸਾਨੂੰ ਉਹ ਗੈਡ ਕਰਦਾ ਗੂਗਲ ਮੈਪ ਦੀ ਵਰਤੋਂ ਦੇ ਨਾਲ ਅਸੀਂ ਸਹੀ ਜਗ੍ਹਾ 'ਤੇ ਪਹੁੰਚ ਜਾਂਦੇ ਹਾਂ ਇਹ ਜਿਹੜੀ ਗੂਗਲ ਮੈਪਸ ਦੀ ਐਪ ਹੈਗੀ ਬਹੁਤ ਹੀ ਵਧੀਆ ਇਹ ਇਹਦਾ ਸਾਨੂੰ ਤਕਰੀਬਨ ਸੌ ਪਰਸੈਂਟ ਹੀ ਸਾਨੂੰ ਵਧੀਆ ਰਿਜਲਟ ਮਿਲਦਾ ਪੰਜਾਬ ਤੋਂ ਅਸੀਂ ਕਈ ਵਾਰੀ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਗਏ ਹਾਂ ਤਾਂ ਅਸੀਂ ਆਪਣਾ ਗੂਗਲ ਮੈਪ ਦੇ ਉੱਤੇ ਕੀ ਹੈ ਕਿੱਥੋਂ ਚੱਲਣਾ ਅਸੀਂ ਕਿਹੜੀ ਜਗ੍ਹਾ 'ਤੇ ਪਹੁੰਚਣਾ ਅਸੀਂ ਕਾਫ਼ੀ ਵਾਰ ਇਹਦਾ ਰਿਜਲਟ ਅਸੀਂ ਦੇਖਿਆ ਸਾਨੂੰ ਬਹੁਤ ਵਧੀਆ ਇਹਦਾ ਰਿਜਲਟ ਮਿਲਿਆ ਇੱਕ ਵਾਰੀ ਤੁਸੀਂ ਇਹ ਗੂਗਲ ਮੈਪਸ ਦੀ ਐਪ ਦੇ ਉੱਤੇ ਐਟਰੀ ਕਰ ਦਿਓ ਆਪਣੀ ਤੁਹਾਨੂੰ ਇਹ ਡਰੈਕਸ਼ਨ ਕਿੰਨੇ ਕਿਲੋਮੀਟਰ ਆ ਕਿੰਨਾ ਸਮਾਂ ਲੱਗੂਗਾ ਸਾਰਾ ਕੁਛ ਕੀ ਹੈ ਇਹ ਨਾਲ ਦੀ ਨਾਲ ਦੱਸਦਾ ਜਾਊਗਾ ਵੀ ਹੁਣ ਅਸੀਂ ਕਿੱਥੇ ਪਹੁੰਚ ਗਏ ਹਾਂ ਕਿੰਨੇ ਕਿਲੋਮੀਟਰ ਅਸੀਂ ਆ ਗਏ ਹਾਂ ਕਿੰਨੇ ਕਿਲੋਮੀਟਰ ਕੀ ਹੈ ਇੱਥੋਂ ਸਾਡਾ ਰਸਤਾ ਜਿਹੜਾ ਬਚਦਾ ਇਹ ਅਣਜਾਣ ਵਿਅਕਤੀ ਵਾਸਤੇ ਜਿਹੜੀ ਐਪ ਆ ਇਹ ਬਹੁਤ ਵਧੀਆ ਗੂਗਲਸ ਮੈਪ ਇਹਦੀ ਅਸੀਂ ਪ੍ਰੈਕਟੀਕਲ ਵਰਤੋਂ ਕਰਕੇ ਦੇਖ ਲਈ ਹੈ ਇਹ ਸੌ ਪਰਸੈਂਟ ਸਹੀ ਹੈ ਤਾਂ ਸਾਨੂੰ ਇਸਦਾ ਇਸਤੇਮਾਲ ਕਰਨਾ ਚਾਹੀਦਾ ਬਹੁਤ ਹੀ ਵਧੀਆ ਇਹ ਨਾ ਜਾਣਦੇ ਹੋਏ ਵੀ ਅਸੀਂ ਜਿਹੜੀ ਲੋਕੇਸ਼ਨ ਦੇ ਉੱਤੇ ਜਾਣਾ ਉੱਥੇ ਅਸੀਂ ਘੱਟ ਸਮੇਂ ਦੇ ਵਿੱਚ ਘੱਟ ਰਸਤਾ ਤੈਅ ਕਰਕੇ ਘੱਟ ਸਮੇਂ ਦੇ ਵਿੱਚ ਸਹੀ ਜਗ੍ਹਾ 'ਤੇ ਕੀ ਹੈ ਅਸੀਂ ਗੂਗਲ ਮੈਪਸ ਦੀ ਮਦਦ ਦੇ ਨਾਲ ਓਥੇ ਪਹੁੰਚ ਜਾਂਦੇ ਹਾਂ ਜਿਹੜਾ ਤੁਸੀਂ ਇਹਦੇ ਬਾਰੇ ਪੁੱਛਿਆ ਕਿੰਨੇ ਪਰਸੈਂਟ ਸਹੀ ਹੈ ਮੇਰੇ ਵਿਊ ਦੇ ਮੁਤਾਬਕ ਅਸੀਂ ਜਿਵੇਂ ਇਸਤੇਮਾਲ ਕੀਤਾ ਇਹਨੂੰ ਸੌ ਪਰਸੈਂਟ ਸਹੀ ਹੈ ਇਹ ਮੈਪਸ ਨੇ ਸਾਨੂੰ ਬਹੁਤ ਹੀ ਅਸਾਨ ਕਰਤਾ ਇਹਦੀ ਵਰਤੋਂ ਕਰਨ ਨਾਲ ਸਾਨੂੰ ਸਮੇਂ ਦੀ ਬੱਚਤ ਹੁੰਦੀ ਹੈ ਅਗਰ ਵਹੀਕਲ 'ਤੇ ਜਾਂਦੇ ਅਸੀਂ ਸਹੀ ਰਸਤਾ ਮਿਲ ਜਾਂਦਾ ਸਾਨੂੰ ਤੇਲ ਦੀ ਕੰਜਮਪਸ਼ਨ ਘੱਟ ਹੁੰਦੀ ਹੈ ਯਾਨੀ ਕਿ ਤੇਲ ਘੱਟ ਖਰਚ ਹੁੰਦਾ ਵਧੀਆ ਤਰੀਕੇ ਦੇ ਨਾਲ ਅਸੀਂ ਇਸ ਐਪ ਦੀ ਮਦਦ ਦੇ ਨਾਲ ਸਹੀ ਜਗ੍ਹਾ 'ਤੇ ਪਹੁੰਚ ਜਾਂਦੇ ਹਾਂ ਇਹ ਐਪ ਆ ਜਿਹੜੀ ਅਸੀਂ ਵਰਤੋਂ ਕਰਕੇ ਦੇਖ ਲਈ ਹੈ ਸੌ ਪਰਸੈਂਟ ਸਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ